ਹੈਲੋ ਮੈਂ ਅੱਜ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਿਹਾ ਹਾਂ ਜਿਹੜਾ ਕਿ ਮੈਂ ਔਨਲਾਈਨ ਹੋਮ ਥੀਏਟਰ ਸਪੀਕਰਸ ਮੰਗਵਾਏ ਸੀਗੇ ਲੋਹੜੀ ਦਾ ਟਾਈਮ ਸੀਗਾ ਅਤੇ ਮੈਂ ਚਾਰ ਕੁ ਦਿਨ ਪਹਿਲਾਂ ਹੀ ਔਨਲਾਈਨ ਹੋ ਹੋਮ ਥੀਏਟਰ ਸਪੀਕਰਸ ਮੰਗਵਾਏ ਜਿਹਨੂੰ ਕਿ ਮੈਂ ਲੋਹੜੀ 'ਤੇ ਯੂਜ ਕਰਨਾ ਚਾਹੁੰਦਾ ਸੀਗਾ ਅੱਛਾ ਮੈਂ ਬਾ ਇਹ ਇਹ ਬਹੁ ਇਹ ਚੀਜ਼ ਤੋਂ ਬਹੁਤ ਖੁਸ਼ ਹੋਇਆ ਕਿ ਉਹ ਲੋਹੜੀ ਤੋਂ ਵੀ ਇੱਕ ਦਿਨ ਪਹਿਲਾਂ ਹੀ ਆ ਗਏ ਉਹਨਾਂ ਦੀ ਸਰਵਿਸਿਸ ਕਾਫੀ ਫਾਸਟ ਸੀਗੀਆਂ ਐਂਡ ਜਦੋਂ ਮੈਂ ਪ੍ਰੋਡਕਟ ਦੀ ਪੈਕਜਿੰਗ ਖੋਲ੍ਹੀ ਐਂਡ ਉਹਨਾਂ ਦੀ ਪ੍ਰੋਡਕਟ ਪੈਕਜਿੰਗ ਵੀ ਬਹੁਤ ਸਹੀ ਸੀਗੀ ਬੜੇ ਹੀ ਵਧੀਆ ਤਰੀਕੇ ਨਾਲ ਪੈਕ ਕੀਤਾ ਗਿਆ ਸੀਗਾ ਕਿ ਜਿਹਦੇ ਨਾਲ ਉਹਨੂੰ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਪਹੁੰਚੇ ਅਤੇ ਪੈਕਜਿੰਗ ਖੋਲ੍ਹਦਿਆਂ ਹੀ ਉਸ ਹੋ ਹੋ ਉਹ ਹੋਮ ਥੀਏਟਰ ਬਹੁਤ ਹੀ ਵਧੀਆ ਤਰੀਕੇ ਦਾ ਸੀਗਾ ਪ ਉਸ ਉਸਦੀ ਸਾਊਂਡ ਕੁਆਲਿਟੀ ਐਂਡ ਉਸਦੇ ਉਸਦੇ ਉੱਪਰ ਜਿਹੜੀਆਂ ਐੱਲ ਈ ਡੀ ਲਾਈਟਸ ਲੱਗੀਆਂ ਹੋਈਆਂ ਸੀ ਉਹ ਬਹੁਤ ਹੀ ਆਕਰਸ਼ਕ ਸੀਗੀਆਂ ਇਸ ਲਈ ਜਦੋਂ ਅਸੀਂ ਲੋਹੜੀ 'ਤੇ ਉਹਨੂੰ ਚਲਾਇਆ ਕਾਫੀ ਦੋਸਤਾਂ ਵਗੈਰਾ ਦੇ ਨਾਲ ਬਹੁਤ ਹੀ ਸਾਨੂੰ ਮਜ਼ਾ ਆਇਆ ਅਤੇ ਉਸ ਦੇ ਨਾਲ ਇੱਕ ਮਾਈਕ ਵੀ ਫਰੀ ਮਿਲਿਆ ਸੀਗਾ ਸਾਨੂੰ ਜਿਹਦੇ ਨਾਲ ਕਿ ਅਸੀਂ ਬਹੁਤ ਹੀ ਵਧੀਆ ਲੋਹੜੀ ਨੂੰ ਇੰਜੋਏ ਕੀਤਾ ਅਤੇ ਜਦੋਂ ਮੈਂ ਉਸ ਸਪੀਕਰ ਨਾਲ ਬਾਕੀ ਸਭ ਦੋਸਤਾਂ ਨੂੰ ਦਿਖਾਇਆ ਤਾਂ ਉਹਨਾਂ ਨੂੰ ਵੀ ਉਹ ਚੀਜ਼ ਬਹੁਤ ਵੀ ਵਧੀਆ ਲੱਗੀ ਸਭ ਨੇ ਮੇਰੇ ਕੋਲੋਂ ਇਸ ਚੀਜ਼ ਬਾਰੇ ਪੁੱਛਿਆ ਅਤੇ ਸਭ ਸਭ ਨੂੰ ਮੈਂ ਦੱਸਿਆ ਕਿ ਮੈਂ ਇਸ ਤਰ੍ਹਾਂ ਔਨਲਾਈਨ ਮੰਗਵਾਏ ਸੀ ਐਂਡ ਡਿਲੀਵਰੀ ਵੀ ਬਹੁ ਬਹੁਤ ਟਾਈਮ ਸਿਰ ਕਰ ਦਿੱਤੀ ਸੀਗੀ ਅਤੇ ਸਭ ਨੂੰ ਹੀ ਉਹ ਬਹੁਤ ਵਧੀਆ ਲੱਗਿਆ ਅਤੇ ਹੁਣ ਮੈਂ ਸਾਰਿਆਂ ਨੂੰ ਹੀ ਇਹ ਚੀਜ਼ ਰਿਕਮੈਂਡ ਕਰਦਾ ਕਿ ਔਨਲਾਈਨ ਔਨਲਾਈਨ ਮੰਗਵਾਉਣ ਦਾ ਬਹੁਤ ਹੀ ਫਾਇਦਾ ਹੈ ਤੁਹਾਨੂੰ ਪ੍ਰੋਡਕਟ ਦਾ ਰਿਵਿਊ ਵੀ ਵਧੀਆ ਮਿਲ ਜਾਂਦਾ ਹੈ ਅਤੇ ਡਿਲੀਵਰੀ ਵੀ ਬਹੁਤ ਜਲਦ ਘਰ ਬੈਠਿਆਂ ਹੀ ਪਹੁੰਚ ਜਾਂਦੀ ਹੈ ਥੈਂਕ ਯੂ